ਮੈਨੂੰ ਜਿਹੜੀ ਸਭ ਤੋਂ ਵੱਧ ਚੀਜ਼ ਆ ਖੁਸ਼ ਕਰਦੀ ਆ ਉਹ ਆਪਣੇ ਆਪ ਨੂੰ ਟਾਈਮ ਦੇਣਾ ਜਿਵੇਂ ਆਪਣੇ ਸਰੀਰ ਲਈ ਹੈ ਨਾ ਆਪਣੇ ਆਪ ਨੂੰ ਫਿਜੀਕਲ ਫਿਟ ਰੱਖਣਾ ਅਤੇ ਉਹਦੇ ਲਈ ਮਤਲਬ ਮੈਂ ਸਵੇਰੇ ਜਲਦੀ ਉੱਠਦੀ ਹਾਂ ਜਲਦੀ ਉੱਠ ਕੇ ਗਰਾਉਂਡ ਜਾਂਦੀ ਹਾਂ ਰਨਿੰਗ ਕਰਨਾ ਮੈਨੂੰ ਬਹੁਤ ਸੋਹਣਾ ਲੱਗਦਾ ਚਾਹੇ ਉਹ ਮੈਂ ਇਕੱਲੀ ਕਰਾਂ ਚਾਹੇ ਆਪਣੇ ਬੱਚਿਆਂ ਨੂੰ ਲਾਵਾਂ ਚਾਹੇ ਆਪਣੇ ਨਾਲ ਕੋਈ ਵੀ ਪਾਰਟਨਰ ਆ ਜਿਹੜਾ ਲਵਾਂ ਹੈ ਨਾ ਰਨਿੰਗ ਕਰਨੀ ਐਕਸਰਸਾਈਜ਼ ਕਰਨੀ ਉਹਦੇ ਨਾਲ ਇਹ ਹੁੰਦਾ ਵੀ ਸਾਡਾ ਜਿਹੜਾ ਮਨ ਆ ਉਹਦੇ ਵਿੱਚ ਜਿਹੜੀ ਸਟਰੈਸ ਆ ਉਹ ਬਹੁਤ ਘੱਟ ਜਾਂਦੀ ਆ ਅਤੇ ਅਸੀਂ ਹਾਂ ਜਿਹੜੇ ਆਪਣੇ ਆਪ ਨੂੰ ਫਿਜੀਕਲੀ ਫਿਟ ਰੱਖਦੇ ਹਾਂ ਜਦੋਂ ਅਸੀਂ ਐਕਸਰਸਾਈਜ਼ ਕਰਦੇ ਹਾਂ ਜਾਂ ਕੋਈ ਵੀ ਕਸਰਤ ਕਰਦੇ ਹਾਂ ਸਾਡਾ ਸਰੀਰ ਸਾਨੂੰ ਬਹੁਤ ਹਲਕਾ ਫੀਲ ਹੁੰਦਾ ਕਿਸੇ ਤਰ੍ਹਾਂ ਦਾ ਕੋਈ ਸਾਹ ਨਹੀਂ ਹੁੰਦਾ ਬੁਖਾਰ ਨਹੀਂ ਚੜ੍ਹਦਾ ਕੋਈ ਵੀ ਬਿਮਾਰੀ ਆ ਜਿਹੜੀ ਨੇੜੇ ਨਹੀਂ ਆਉਂਦੀ ਫਿਰ ਅਸੀਂ ਫਿਜੀਕਲੀ ਫਿਟਨੈਸ ਦੇ ਰੱਖਣ ਦੇ ਨਾਲ ਨਾਲ ਹੈ ਨਾ ਆਪਣੀ ਅਤੇ ਫਿਰ ਅਸੀਂ ਖਾਣ ਪੀਣ ਦਾ ਵੀ ਪੂਰਾ ਧਿਆਨ ਰੱਖਦੇ ਹਾਂ ਅਸੀਂ ਦੇਖਦੇ ਹਾਂ ਵੀ ਅੱਜ ਕੱਲ੍ਹ ਦੇ ਵਾਧੂ ਜਿਹੜਾ ਜੰਕ ਫੂਡ ਨੇ ਉਹਨਾਂ ਨੂੰ ਅਸੀਂ ਘੱਟ ਤੋਂ ਘੱਟ ਆਪਣੀ ਰੋਜ਼ਾਨਾ ਦੇ ਭੋਜਨ ਵਿੱਚ ਸ਼ਾਮਿਲ ਕਰੀਏ ਫਿਰ ਅਸੀਂ ਫੋਨ 'ਤੇ ਵੀ ਉਹ ਚੀਜ਼ ਨੂੰ ਵੀ ਜਿਵੇਂ ਅਸੀਂ ਐਕਸਰਸਾਈਜ ਕਰਦੇ ਹਾਂ ਉਹਨੂੰ ਆਪਾਂ ਹੋਰ ਵੀ ਕਿਵੇਂ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਹੈ ਨਾ ਤਾਂ ਜੋ ਜਾਂ ਆਪਣੇ ਆਪ ਨੂੰ ਫਿਟ ਰੱਖ ਸਕਦੇ ਹਾਂ ਬਿਮਾਰੀਆਂ ਤੋਂ ਦੂਰ ਕਰ ਸਕਦੇ ਹਾਂ ਤਾਂ ਫੋਨ 'ਤੇ ਅਸੀਂ ਬਹੁਤ ਜ਼ਿਆਦਾ ਵੀਡੀਓ ਨੇ ਜਿਹੜੀਆਂ ਉਹ ਸਰਚ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ ਹੈ ਨਾ ਵੀ ਜਾਂ ਅਸੀਂ ਆਪਣੇ ਰੋਲ ਮਾਡਲ ਲੱਭਦੇ ਹਾਂ ਵੀ ਕਿਹੜੇ ਬੰਦੇ ਨੇ ਆਪਣੇ ਆਪ ਨੂੰ ਫਿਟ ਰੱਖਿਆ ਹੋਇਆ ਕਿਹਨੂੰ ਰੂਲ ਐਂਡ ਰੈਗੂਲੇਸ਼ਨਸ ਆਪਣੀ ਲਾਈਫ 'ਤੇ ਪਸੰਦ ਨੇ ਜੇ ਅਸੀਂ ਸਵੇਰੇ ਜਲਦੀ ਉੱਠ ਕੇ ਐਕਸਰਸਾਈਜ ਕਰਦੇ ਹਾਂ ਉਹਦੇ ਨਾਲ ਪੂਰੇ ਦਿਨ ਐਕਟਿਵ ਰਹਿੰਦੇ ਹਾਂ ਭੱਜੇ ਨੱਠੇ ਸਾਰਾ ਦਿਨ ਆਪਣਾ ਖੁਸ਼ੀ ਖੁਸ਼ੀ ਆਪਣਾ ਕੰਮ ਕਰਦੇ ਹਾਂ ਅਤੇ ਕਿਸੇ ਵੀ ਕੰਮ ਦੇ ਵਿੱਚ ਦੇਰੀ ਨਹੀਂ ਲਗਾਉਂਦੇ ਮਿੰਟਾਂ ਸਕਿੰਟਾਂ 'ਚ ਆਪਣਾ ਕੰਮ ਖਤਮ ਕਰਕੇ ਉਹ ਜਾਂਦੇ ਹਾਂ ਮਤਲਬ ਸਾਰੇ ਦੇਖਦੇ ਰਹਿ ਜਾਂਦੇ ਨੇ ਹਲੇ ਬਾਕੀ ਦੇ ਜਿਹੜੇ ਸੁਸਤ ਲੋਕ ਨੇ ਹੌਲੀ ਉੱਠਣ ਵਾਲੇ ਨੇ ਜਾਂ ਉਹ ਬਸ ਉਹ ਨੈਗਟੀਵਿਟੀ ਜ਼ਿਆਦਾ ਦਿੰਦੇ ਰਹਿੰਦੇ ਨੇ ਪਰ ਜਿਹੜੇ ਸਵੇਰੇ ਜਲਦੀ ਉੱਠਦੇ ਨੇ ਐਕਸਰਸਾਈਜ਼ ਕਰਦੇ ਨੇ ਉਹ ਉਹਨਾਂ ਚ ਪੋਜ਼ੀਟੀਵੀਟੀ ਵਿਟੀ ਬਹੁਤ ਆਉਂਦੀ ਆ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਕਰਨ ਨੂੰ ਲੈ ਕੇ ਆਪਣੇ ਜੀਵਨ ਦੀ ਜਾਂਚ ਨੂੰ ਅੱਗੇ ਉੱਪਰ ਚੁੱਕਣ ਦੇ ਲਈ ਹੈ ਨਾ ਅਸੀਂ ਜਿਹੜੀਆਂ ਕਠਿਨਾਈਆਂ ਵੀ ਆਉਂਦੀਆਂ ਨੇ ਜਦੋਂ ਅਸੀਂ ਆਪਣੇ ਆਪ ਨੂੰ ਸਮਾਂ ਦਿੰਦੇ ਹਾਂ ਚਾਹੇ ਉਹ ਕਸਰਤ ਕਰਨ ਲਈ ਦਿੰਦੇ ਹਾਂ ਚਾਹੇ ਮਿਊਜਿਕ ਸੁਣਨ ਲਈ ਦਿੰਦੇ ਹਾਂ ਕਿਸੇ ਨੂੰ ਸੇਵਾ ਕਰਨਾ ਵੱਧ ਪਸੰਦ ਹੁੰਦਾ ਹੈ ਨਾ ਹਰੇਕ ਲੋਕਾਂ ਦੀ ਆਪਣੀ ਆਪਣੀ ਪਸੰਦ ਆ ਵੀ ਉਹ ਆਪਣੇ ਆਪ ਨੂੰ ਕਿਵੇਂ ਖੁਸ਼ ਰੱਖ ਸਕਦੇ ਨੇ ਕੋਈ ਆਪਣੇ ਫੈਮਲੀ ਦੇ ਨਾਲ ਟਾਈਮ ਸਪੈਂਡ ਕਰਨਾ ਹੀ ਵਧੀਆ ਲੱਗਦਾ ਇੱਕ ਤਾਂ ਮੈਨੂੰ ਸਵੇਰੇ ਉੱਠ ਕੇ ਕਸਰਤ ਕਰਨੀ ਆਪਣੇ ਆਪ ਨੂੰ ਫਿਟ ਰੱਖਣਾ ਵਧੀਆ ਲੱਗਦਾ ਦੂਜਾ ਮੈਂ ਉਹ ਜ਼ਿਆਦਾ ਖੁਸ਼ੀ ਮਹਿਸੂਸ ਉਦੋਂ ਕਰਦੀ ਹਾਂ ਜਦੋਂ ਮੇਰੇ ਫੈਮਲੀ ਮੈਂਬਰਜ਼ ਨੇ ਜਾਂ ਆਪਣੇ ਪਰਿਵਾਰ ਆ ਛੋਟੇ ਜਿਹੇ ਬੱਚੇ ਨੇ ਉਹਦੇ ਵਿੱਚ ਹੈ ਨਾ ਉਹ ਸਾਰੇ ਸਾਡੇ ਨਾਲ ਟਾਈਮ ਕੁਆਲਿਟੀ ਟਾਈਮ ਸਪੈਂਡ ਕਰਦੇ ਨੇ ਇੱਕ ਦੂਜੇ ਦੇ ਦੁੱਖ ਸੁੱਖ ਸੁਣਦੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦੀ ਕੀ ਜ਼ਿੰਦਗੀ ਦੇ ਰੁਝੇਵੇਂ ਰਹੇ ਨੇ ਕਿਹੜੇ ਕਿਹੜੇ ਕੰਮ ਆਪਣੇ ਜ਼ਿੰਦਗੀ 'ਚ ਉਹਨਾਂ ਨੇ ਸੋਚਿਆ ਕਿ ਮੈਂ ਅੱਗੇ ਵਧਣਾ ਆਪਣੇ ਆਪ ਨੂੰ ਲੈ ਕੇ ਜਾਣਾ ਜਾਂ ਕਿਵੇਂ ਹੋਰ ਦੀਨ ਦੁਨੀਆਂ ਦੀ ਜਿਹੜੇ ਦੁਖੀ ਲੋਕ ਨੇ ਉਹਨਾਂ ਦੀ ਹੈਲਪ ਕਰਨੀ ਉਹਨਾਂ ਦੀ ਜਿਹੜੀ ਸੇਵਾ ਜਾਂ ਕਹਿ ਲਉ ਵੀ ਜਾਂ ਉਹਨਾਂ ਦੇ ਥੋੜ੍ਹਾ ਜਿਹਾ ਹੈ ਨਾ ਮਦਦ ਕਰਕੇ ਸਾਨੂੰ ਕਿੰਨੀ ਖੁਸ਼ੀ ਮਿਲਦੀ ਆ ਇਹ ਸਾਰੀਆਂ ਚੀਜ਼ਾਂ ਸਾਨੂੰ ਖੁਸ਼ ਰੱਖਦੀਆਂ ਨੇ ਜੇ ਹੋਰ ਵੀ ਆਪਾਂ ਕਹਿ ਸਕਦੇ ਹਾਂ ਜਿਵੇਂ ਬੱਚਿਆਂ ਦੇ ਜਨਮ ਦਿਨ ਆਉਂਦੇ ਨੇ ਜਾਂ ਸਾਡੀ ਮੈਰਿਜ ਐਨੀਵਰਸਰੀ ਆਉਂਦੀਆਂ ਨੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਉਹਦੇ ਵਿੱਚ ਜਿਹੜੇ ਗਰੀਬ ਲੋਕ ਨੇ ਹੈ ਨਾ ਸਾਡੇ ਤੋਂ ਨੀਚੇ ਲੋਕ ਨੇ ਅਸੀਂ ਉਹਨਾਂ ਦੀ ਮਦਦ ਕਰੀਏ ਜਦੋਂ ਅਸੀਂ ਛੋਟੀ ਜਿਹੀ ਵੀ ਉਹਨਾਂ ਦੀ ਮਦਦ ਕਰਦੇ ਹਾਂ ਆਪਣੇ ਖਰਚੇ ਨੇ ਜਿਹੜੇ ਉਹਨਾਂ ਨੂੰ ਕੰਟਰੋਲ ਕਰ ਲਉ ਤਾਂ ਛੋਟੀ ਜਿਹੀ ਵੀ ਅਸੀਂ ਉਹਨਾਂ ਦੀ ਮਦਦ ਕਰਦੇ ਹਾਂ ਸਾਨੂੰ ਉਹਨਾਂ ਦੇ ਚਿਹਰਿਆਂ 'ਤੇ ਜਿਹੜੀ ਖੁਸ਼ੀ ਆ ਉਹ ਬਹੁਤ ਦੇਖਣ ਨੂੰ ਮਿਲਦੀ ਆ ਤਾਂ ਉਹਨਾਂ ਨੂੰ ਜੋ ਅਸੀਂ ਖੁਸ਼ ਦੇਖਦੇ ਹਾਂ ਨਾ ਤਾਂ ਸਾਨੂੰ ਆਪਣੇ ਆਪ ਨੂੰ ਆਪਣੀ ਜ਼ਿੰਦਗੀ 'ਚ ਸਕੂਨ ਜਿਹੜੀ ਖੁਸ਼ੀ ਆ ਉਹ ਮਿਲਦੀ ਆ ਮੈਂ ਚਾਹੁੰਦੀ ਹਾਂ ਵੀ ਇਹ ਸਾਰੀਆਂ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਪਰ ਅੱਜ ਕੱਲ੍ਹ ਦੇ ਲੋਕ ਨੇ ਜਿਹੜੇ ਉਹ ਜ਼ਿਆਦਾਤਰ ਦਿਖਾਵੇ ਦੇ ਵਿੱਚ ਬਹੁਤ ਪੈ ਗਏ ਉਹ ਆਪਣੇ ਆਪ ਨੂੰ ਖੁਸ਼ ਨਹੀਂ ਕਰਦੇ ਲੋਕ ਉਹ ਦੂਜਿਆਂ ਨੂੰ ਖੁਸ਼ ਰੱਖਣ ਦੇ ਲਈ ਆਪਣੇ ਬ੍ਰੈਂਡਡ ਕੱਪੜੇ ਪਾਉਣੇ ਸ਼ੁਰੂ ਕਰਤੇ ਉਹਨਾਂ ਨੇ ਹੈ ਨਾ ਆਪਣੇ ਆਪ ਨੂੰ ਮਤਲਬ ਜਿਹੜੀ ਲਾਈਫ ਆ ਹਮੇਸ਼ਾਂ ਆਪਣੀ ਜ਼ਿੰਦਗੀ ਦੇ ਵਿੱਚ ਸ਼ੋ ਆਫ ਕਰਦੇ ਰਹਿੰਦੇ ਨੇ ਵੀ ਸਾਡੇ ਕੋਲ ਅਸੀਂ ਬਹੁਤ ਅਮੀਰ ਹਾਂ ਅਸੀਂ ਬ੍ਰੈਂਡਡ ਕੱਪੜੇ ਪਾਉਂਦੇ ਹਾਂ ਬ੍ਰੈਂਡਡ ਸ਼ੂਜ਼ ਪਾਉਂਦੇ ਹਾਂ ਹੈ ਨਾ ਵੀ ਲਗਜ਼ਰੀ ਗੱਡੀਆਂ ਨੇ ਜਿਹੜੀਆਂ ਅਸੀਂ ਉਹ 'ਚ ਰਹਿੰਦੇ ਹਾਂ ਜਦਕਿ ਇਹ ਚੀਜ਼ਾਂ ਸਾਡੇ ਜ਼ਿੰਦਗੀ 'ਚ ਮੈਨੂੰ ਨਹੀਂ ਲੱਗਦਾ ਸਾਨੂੰ ਖੁਸ਼ੀ ਦਿੰਦੀਆਂ ਨੇ ਖੁਸ਼ੀ ਉਹ ਚੀਜ਼ਾਂ ਦਿੰਦੀਆਂ ਨੇ ਜਦੋਂ ਅਸੀਂ ਆਪਣੇ ਆਲੇ ਦੁਆਲੇ ਤੋਂ ਲੱਭਦੇ ਹਾਂ ਅਸੀਂ ਕੁਦਰਤ ਦੇ ਨਾਲ ਜੁੜਦੇ ਹਾਂ ਹੈ ਨਾ ਅਸੀਂ ਪੰਛੀਆਂ ਦੀ ਸੰਭਾਲ ਕਰਦੇ ਹਾਂ ਉਹਨਾਂ ਨੂੰ ਭੋਜਨ ਪ੍ਰੋਵਾਈਡ ਕਰਦੇ ਹਾਂ ਇਹ ਸਾਰੀਆਂ ਚੀਜ਼ਾਂ ਸਾਨੂੰ ਬਹੁਤ ਖੁਸ਼ੀ ਦਿੰਦੀਆਂ ਨੇ ਤੁਸੀਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਥੋੜ੍ਹੇ ਥੋੜ੍ਹੇ ਹੈਲਪ ਚਾਹੇ ਕਿਸੇ ਨਾ ਕਿਸੇ ਦੀ ਹਰ ਰੋਜ਼ ਕਰੋ ਚਾਹੇ ਅਸੀਂ ਸਾਰੇ ਦਿਨ ਕਿੰਨੇ ਵੀ ਪੈਸੇ ਕਮਾਉਂਦੇ ਰਹੀਏ ਪਰ ਜਦੋਂ ਅਸੀਂ ਥੋੜ੍ਹੀ ਜਿਹੀ ਵੀ ਕਿਸੇ ਦੇ ਚਿਹਰੇ 'ਤੇ ਖੁਸ਼ੀ ਮੁਸਕਾਨ ਜਾਂ ਲਿਆਉਣਾ ਚਾਹੁੰਦੇ ਹਾਂ ਜਾਂ ਲਿਆਉਂਦੇ ਹਾਂ ਤਾਂ ਉਹ ਚੀਜ਼ਾਂ ਸਾਨੂੰ ਜ਼ਿੰਦਗੀ 'ਚ ਬਹੁਤ ਖੁਸ਼ੀ ਅਤੇ ਆਨੰਦਿਤ ਦਿੰਦੀਆਂ ਨੇ